ਮੈਂ ਅੱਜ ਦੀ ਜਿਹੜੀ ਹੈ ਦਿਲ ਦਿਲਚਸਪ ਜਿਹੜੀ ਹੈਗੀ ਹੈ ਘਟਨਾ ਸੁਣਾਉਣ ਦੀ ਕਰ ਰਹੀ ਹਾਂ ਕਿ ਜਿਸ ਤਰ੍ਹਾਂ ਕਿ ਅੱਜ ਮੈਂ ਆਪਣੀ ਵਹੀਕਲ 'ਤੇ ਜਾ ਰਹੀ ਸੀ ਮੇਰੇ ਵਹੀਕਲ ਦੇ ਨਾਲ਼ ਇੱਕ ਬਾਈਕ ਵਾਲਾ ਬੜਾ ਹੀ ਚੰਗਾ ਮੁੰਡਾ ਸੀ ਅਤੇ ਬੜਾ ਹੀ ਹੈਂਡਸਮ ਸੀਗਾ ਉਹਨੇ ਪੂਰੀ ਵੈੱਲ ਡਰੈੱਸ ਸੀ ਅਤੇ ਅਸੀਂ ਦੋਨੋਂ ਹੀ ਸਪੀਡ ਵਿੱਚ ਜਾ ਰਹੇ ਸੀ ਜਾਂਦੇ ਜਾਂਦੇ ਕੀ ਹੋਇਆ ਕਿ ਮੇ ਲਾਈਟਾਂ ਦੇ ਉੱਤੇ ਮੇਰਾ ਧਿਆਨ ਗਿਆ ਕਿ ਉਹਦੀ ਜਿਹੜੀ ਹੈਗੀ ਆ ਟਰਾਊਜ਼ਰ ਹੈ ਉਹ ਨੀਚੋਂ ਸੋਕਸ ਦੇ ਵਿੱਚ ਅੜੀ ਹੋਈ ਹੈ ਮੈਂ ਉਹਨੂੰ ਕਹਿ ਤਾ ਮੈਂ ਕਿਹਾ ਬਈ ਆਹ ਤੁਹਾਡੀ ਟਰਾਊਜ਼ਰ ਵਿੱਚ ਅੜੀ ਹੋਈ ਹੈ ਉਹ ਦੇਖੀ ਜਾਏ ਕੀ ਹੋਇਆ ਕੀ ਹੋਇਆ ਇੰਨੇ ਨੂੰ ਲਾਈਟ ਹੋ ਗਈ ਉਹ ਦੋਨਾਂ ਨੇ ਅਸੀਂ ਨੇ ਆਪਣੇ ਆਪਣੇ ਵਹੀਕਲ ਚਲਾਏ ਅਤੇ ਅੱਗੇ ਵੱਧ ਗਏ ਉਹ ਸਾਰੇ ਰਸਤੇ ਇੰਨੀ ਸਲੋਅ ਗਿਆ ਜਦ ਕਿ ਉਹਦਾ ਜਿਹੜਾ ਬਾਈਕ ਸੀ ਉਹ ਪੂਰੀ ਫੁੱਲ ਸਪੀਡ ਵਾਲੀ ਬਾਈਕ ਸੀ ਉਹ ਬੜੇ ਹੀ ਸਲੋਅ ਸਲੋਅ ਚਲਾਈ ਗਿਆ ਅਤੇ ਨਾਲ਼ ਆਪਣੀ ਟਰਾਊਜ਼ਰ ਨੂੰ ਦੇਖਦਾ ਗਿਆ ਰਸਤੇ ਵਿੱਚ ਦੂਸਰੀ ਲਾਈਟ ਆਈ ਉੱਥੇ ਜਾ ਕੇ ਉਹਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੋਈ ਮੈਂ ਕਿਹਾ ਵੀ ਇਹ ਤੁਹਾਡੀ ਟਰਾਊਜ਼ਰ ਸੋਕਸ 'ਚ ਫਸੀ ਹੋਈ ਹੈ ਜਦ ਕਿ ਉਹ ਮੈਨੂੰ ਕਹਿੰਦਾ ਕਿ ਨਹੀਂ ਇਹ ਤਾਂ ਮੇਰੀ ਪੈਂਟ ਨੂੰ ਫੋਲਡ ਕੀਤਾ ਹੋਇਆ ਜਦ ਕਿ ਇਹ ਮੈਂ ਸੋਕਸ ਵਿੱਚ ਅੜਾਇਆ ਨਹੀਂ ਹੋਇਆ ਇਹ ਸੀ ਮੇਰੀ ਦਿਲਚਸਪ ਘਟਨਾ ਜਦ ਕਿ ਅੱਗੇ ਜਾ ਕੇ ਮੈਨੂੰ ਆਪਣੇ ਆਪ ਨੂੰ ਬੜਾ ਫੀਲ ਹੋਇਆ ਕਿ ਇਹ ਮੈਂ ਉਹਨੂੰ ਬਿਨਾਂ ਮਤਲਬ ਤੋਂ ਜਾਂਦੇ ਮਤਲਬ ਜਿਹੜਾ ਬੰਦਾ ਸੀਗਾ ਉਹਨੂੰ ਜਾਂਦੇ ਰੋਕਿਆ ਅਤੇ ਉਹਨੂੰ ਸਾਰਾ ਰਸਤਾ ਉਹਦਾ ਮੈਂ ਖ਼ਰਾਬ ਕੀਤਾ ਇਹ ਦਿਲਚਸਪ ਘਟਨਾ ਸੀ ਮੇਰੀ